ਪੰਜਾਬੀ ਪਰਿਵਾਰ ਆਮ ਤੌਰ 'ਤੇ ਜਨਮਦਿਨ ਅਤੇ ਹੋਰ ਵਿਸੇਖ ਵਿਸ਼ੇਸ਼ ਮੌਕਿਆਂ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਉਂਦੇ ਹਨ ਪੁਰਾਣੇ ਸਮੇਂ ਦੇ ਵਿੱਚ ਲੋਕ ਜੋ ਆਪਣਾ ਜਨਮਦਿਨ ਸੀ ਅਤੇ ਹੋਰ ਕੋਈ ਵਿਸ਼ੇਸ਼ ਤਿਉਹਾਰ ਸੀ ਤਾਂ ਉਸਨੂੰ ਰਲ ਮਿਲ ਕੇ ਬਹੁਤ ਖੁਸ਼ੀ ਨਾਲ ਮਨਾਉਂਦੇ ਸਨ ਉਸ ਦਿਨ ਉਹ ਆਪਣੇ ਘਰ ਵਿੱਚ ਹੀ ਮਿੱਠਾ ਪਕਵਾਨ ਬਣਾਉਂਦੇ ਸੀ ਅਤੇ ਘਰ ਸਭ ਨਿਰਣੇ ਰਲ ਮਿਲ ਕੇ ਖਾਂਦੇ ਸੀ ਨੱਚਦੇ ਟੱਪਦੇ ਸੀ ਗੀਤ ਗਾਉਂਦੇ ਸੀ ਸਭ ਕੁਛ ਸਭ ਇਕੱਠੇ ਕਰਦੇ ਹੁੰਦੇ ਸੀ ਪਰ ਅੱਜ ਕੱਲ੍ਹ ਜੋ ਹੈ ਅੱਜ ਕੱਲ੍ਹ ਦੇ ਪੰਜਾਬੀ ਪਰਿਵਾਰਾਂ ਦੇ ਵਿੱਚ ਜੋ ਕਿ ਚੱਲ ਰਿਹਾ ਹੈ ਕਿ ਬੱਚੇ ਆਪਣਾ ਜਨਮ ਦਿਨ ਜੋ ਪਰਿਵਾਰ ਹੈ ਆਪਣਾ ਜਾਂ ਹੋਰ ਵਿਸ਼ੇਸ਼ ਮੌਕੇ ਤਿਉਹਾਰ ਹਨ ਉਹ ਬਾਹਰ ਜਾ ਕੇ ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ ਮਿਲ ਮਿਲ ਕੇ ਮਨਾਉਂਦੇ ਹਨ ਅਤੇ ਉੱਥੇ ਉਹ ਕੇਕ ਕੱਟਦੇ ਨੱਚਦੇ ਗਾਣਿਆਂ 'ਤੇ ਨੱਚਦੇ ਪੰਜਾਬੀ ਹੋਰ ਸੱਭਿਆ ਹੋਰ ਸੱਭਿਆਚਾਰ ਲੋਕ ਗੀਤ ਕਰਦੇ ਨੱਚਦੇ ਟੱਪਦੇ ਅਤੇ ਖੁਸ਼ੀ ਨਾਲ ਮਨਾਉਂਦੇ ਹਨ ਅਤੇ ਬਹੁਤ ਹੀ ਜ਼ਿਆਦਾ ਲੋਕਾਂ ਦਾ ਇਕੱਠ ਕਰਕੇ ਨੱ ਨੱਚਦੇ ਹਨ